ਇਸ ਵਕਤ ਮੈਂ ਇੱਕ ਵਪਾਰਕ ਮੀਟਿੰਗ ਦੀ ਯਾਤਰਾ ਲਈ ਬੈਂਗਲੋਰ ਜਾ ਰਹੀ ਹਾਂ ਅਤੇ ਮੈਂ ਇੱਕ ਟਰੇਨ ਦੇ ਵਿੱਚ ਸਫਰ ਕਰ ਰਹੀ ਹਾਂ ਮੈਨੂੰ ਮੇਰੀ ਯਾਤਰਾ 'ਤੇ ਕਿੰਨਾ ਖਰਚਾ ਹੋ ਜਾਏਗਾ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਹੈ ਤਾਂ ਇਸ ਕਰਕੇ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਅਪਡੇਟਿਡ ਰਹੋ ਅਤੇ ਮੈਨੂੰ ਦੱਸਦੇ ਰਹੋ ਕਿ ਮੇਰਾ ਖਰਚਾ ਕਿੰਨਾ ਬਣ ਸਕਦਾ ਹੈ ਮੇਰੀ ਟਰੇਨ ਦਾ ਨੰਬਰ ਹੈ ਜ਼ੀਰੋ ਸਿਕਸ ਸੈਵਨ ਨਾਈਨ ਟੂ ਫੋਰ ਅਤੇ ਟਰੇਨ ਹੈ ਸ਼ਤਾਬਦੀ ਐਕਸਪ੍ਰੈਸ ਵੈਸੇ ਤਾਂ ਮੈਂ ਸੈਕਿੰਡ ਕਲਾਸ ਵਿੱਚ ਸੀਟ ਲਈ ਹੋਈ ਹੈ ਪਰ ਜਿਵੇਂ ਹੀ ਜਾਣ ਦੇ ਵਿੱਚ ਮੈਨੂੰ ਤਿੰਨ ਦਿਨ ਲੱਗ ਜਾਣਗੇ ਤਾਂ ਮੈਂ ਸਲੀਪਰ ਵੀ ਬੁੱਕ ਕਰਵਾਇਆ ਹੈ ਅਤੇ ਸਲੀਪਰ ਦਾ ਕੁੱਲ ਖਰਚਾ ਇੱਕ ਰਾਤ ਦਾ ਸੱਤ ਸੌ ਰੁਪਏ ਦਾ ਹੈ ਮੇਰੀ ਟਰੈਵਲਿੰਗ ਦੀ ਡੇਟਸ ਨੇ ਤੇਈ ਸਤੰਬਰ ਤੋਂ ਲੈ ਕੇ ਛੱਬੀ ਸਤੰਬਰ ਤੱਕ ਦੀ ਅਤੇ ਮੈਨੂੰ ਮੇਰੇ ਬਜੇਟ ਦਾ ਨਹੀਂ ਪਤਾ ਕਿ ਕਿੰਨਾ ਕੁ ਖਰਚਾ ਹੋ ਸਕਦਾ ਹੈ ਤਾਂ ਮੈਂ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਕਿ ਵੈਸੇ ਟਿਕਟ ਦੀ ਵੈਸੇ ਵੀ ਟਰੇਨ ਦੀ ਟਿਕਟ ਹੈ ਛੇ ਸੌ ਰੁਪਏ ਇੱਕ ਦਿਨ ਦਾ ਅਤੇ ਟੋਟਲ ਫੇਅਰ ਬਣ ਜਾਊਗਾ ਛੇ ਸੌ ਟਿਕਟ ਦੀ ਟਰੇਨ ਵਿੱਚ ਇਹ ਖਾਣ ਪੀਣ ਦਾ ਖਰਚਾ ਵੱਖਰਾ ਅਤੇ ਦੂਜੇ ਤੀਜੇ ਖਰਚੇ ਹੋਰ ਵੀ ਹੋ ਜਾਣਗੇ ਜਿਵੇਂ ਕਿ ਕੋਈ ਕੁਝ ਖਰੀਦਣ ਦਾ ਖਰਚਾ ਜਾਂ ਹੋਰ ਜੇ ਮੈਂ ਕੋਈ ਕੁਲੀ ਵੀ ਕਰਾਂ ਆਪਦਾ ਸਮਾਨ ਚੁੱਕਣ ਵਾਸਤੇ ਤਾਂ ਉਹ ਵੀ ਬਹੁਤ ਜ਼ਿਆਦਾ ਪੈ ਸਕਦਾ ਹੈ ਤਾਂ ਕਰਕੇ ਤੁਸੀਂ ਮੈਨੂੰ ਪਲੀਜ਼ ਆਹ ਹੈਲਪ ਕਰ ਦਿਓ ਕਿ ਮੈਨੂੰ ਮੇਰੇ ਖਰਚੇ ਦੱਸੀ ਜਾਓ ਤਾਂ ਜੋ ਮੈਂ ਆਪਦੇ ਖਰਚੇ ਨੇ ਉਹ ਵਧਾ ਘਟਾ ਸਕਾ ਅਤੇ ਆਪਦੀ ਜ਼ਰੂਰਤ ਦੇ ਅਨੁਸਾਰ ਸਭ ਕੁਝ ਕਰ ਸਕਾਂ ਅਤੇ ਜੇ ਮੈਨੂੰ ਕੋਈ ਐਡਜਸਟਮੈਂਟ ਵੀ ਕਰਨ ਦੀ ਲੋੜ ਪਏ ਆਪਦੇ ਖਰਚਿਆਂ ਦੇ ਵਿੱਚ ਤਾਂ ਉਹ ਵੀ ਦੱਸ ਦਿਓ ਕਿਉਂਕਿ ਮੈਂ ਹਾਲੇ ਤਾਂ ਇੰਨਾ ਕਦੇ ਟਰੈਵਲ ਕੀਤਾ ਨਹੀਂ ਹੈ ਟਰੇਨਾਂ ਦੇ ਵਿੱਚ ਪਰ ਤੁਸੀਂ ਤਾਂ ਸਫਰ ਕਰਦੇ ਹੀ ਰਹਿੰਦੇ ਹੋ ਤਾਂ ਬਸ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਮੇਰੀ ਹੈਲਪ ਕਰਦੇ ਰਹੀਓ ਨਾਲੇ ਤੁਸੀਂ ਮੇਰੇ ਤੋਂ ਵੱਡੇ ਹੋ ਆਸ਼ਾ ਹੈ ਕਿ ਤੁਸੀਂ ਮੇਰੀ ਗੱਲ ਨੂੰ ਸਮਝੋਗੇ